ਸੰਗੀਤ ਦੇ ਨਾਲ ਮੈਂ ਬੜੀ ਦੇਰ ਤੋਂ ਜੁੜੀ ਹੋਈ ਹਾਂ ਮੈਨੂੰ ਸੰਗੀਤ ਦੇ ਬੋਲਣ ਦਾ ਬੜਾ ਹੀ ਸ਼ੋਂਕ ਰਹਿੰਦਾ ਸਾਡੀ ਇੱਕ ਭਜਨ ਮੰਡਲੀ ਬਣੀ ਹੋਈ ਹੈ ਤਖ਼ਤ 'ਤੇ ਅਸੀਂ ਦਿਨ ਰਾਤ ਸਵੇਰ ਸ਼ਾਮ ਕੀਰਤਨ ਸਤਸੰਗ ਵਗੈਰਾ ਕਰਦੇ ਹੀ ਰਹਿੰਦੇ ਹਾਂ ਇਸ ਕਰਕੇ ਸਾਨੂੰ ਸੰਗੀਤ ਬਹੁਤ ਚੰਗਾ ਲੱਗਦਾ ਹੈ ਸੰਗੀਤ ਬੋਲਣ ਦੇ ਵਿੱਚ ਅਸੀਂ ਗਲੇ ਨੂੰ ਗਲੇ ਦੀ ਸੰਭਾਲ ਬੜੀ ਚੰਗੀ ਤਰ੍ਹਾਂ ਕਰਦੇ ਹਾਂ ਕਿਉਂਕਿ ਸਾਡਾ ਬੋਲਣ ਮਾਈਕ ਵਿੱਚ ਬੋਲਣ ਨਾਲ ਕੋਈ ਗਲਾ ਖ਼ਰਾਬ ਨਾ ਹੋ ਜਾਵੇ ਗਲੇ ਦੇ ਪਰਹੇਜ ਵਾਸਤੇ ਅਸੀਂ ਕੀ ਕਰਦੇ ਐਂ ਅਸੀਂ ਕਰਦੇ ਐਂ ਵੀ ਕੋਸਾ ਪਾਣੀ ਪੀ ਲੈਂਦੇ ਐਂ ਅਤੇ ਅਦਰਕ ਇਲਾਇਚੀ ਛੋਟੀ ਮਿਸ਼ਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਨਾਲ ਨਾਲ ਵਰਤਦੇ ਐਂ ਤਾਂ ਕਿ ਸਾਡਾ ਗਲਾ ਖ਼ਰਾਬ ਨਾ ਹੋਵੇ ਅਤੇ ਕੋਸਾ ਪਾਣੀ ਪੀਂਦੇ ਹੀ ਰਹਿੰਦੇ ਹਾਂ ਅਤੇ ਸਾਨੂੰ ਅਸੀਂ ਬਾਹਰ ਵੀ ਜਾਂਦੇ ਐਂ ਅਸੀਂ ਸਤਸੰਗ ਕਰਨ ਵਾਸਤੇ ਸਾਨੂੰ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਅਸੀਂ ਆਪਣੇ ਗਲੇ ਦਾ ਧਿਆਨ ਰੱਖਦੇ ਐਂ ਅਤੇ ਅਸੀਂ ਗਲੇ ਨੂੰ ਖ਼ਰਾਬ ਹੋਣ ਦਾ ਮੌਕਾ ਹੀ ਨਹੀਂ ਦਿੰਦੇ ਇਸ ਕਰਕੇ ਸਾਨੂੰ ਸੰਗੀਤ ਬੜਾ ਚੰਗਾ ਲੱਗਦਾ ਹੈ